ਮੇਰੀ ਬਚਪਨ ਤੋਂ ਹੀ ਡਰਾਇੰਗ ਕਰਨ ਵਿੱਚ ਰੁਚੀ ਹੈ ਮੈਂ ਕਿਸੇ ਵੀ ਕਿਸਮ ਦੀ ਡਰਾਇੰਗ ਜਾਂ ਕੋਈ ਫੋਟੋ ਨੂੰ ਹੂ ਬ ਹੂ ਬਣਾ ਸਕਦਾ ਹਾਂ ਮੇਰਾ ਬਚਪਨ ਤੋਂ ਹੀ ਇੰਟਰਸਟ ਸੀ ਵੀ ਮੈਂ ਇੱਕ ਚੰਗਾ ਆਰਟਿਸਟ ਬਣਾ ਅਤੇ ਮੈਂ ਆਪਣੇ ਸਾਹਮਣੇ ਕਿਸੇ ਮਨੁੱਖ ਨੂੰ ਖੜ੍ਹਾ ਕੇ ਅਤੇ ਉਸ ਦੀ ਹੂ ਬ ਹੂ ਫੋਟੋ ਨੂੰ ਬਣਾ ਸਕਦਾ ਹਾਂ ਅਤੇ ਮੇਰੀਆਂ ਬਣਾਈਆਂ ਫੋਟੋਆਂ ਮਾਰਕੀਟ ਵਿੱਚ ਵੱਧ ਮੁੱਲ 'ਤੇ ਸੇਲ ਹੁੰਦੀਆਂ ਹਨ